ਪੰਜਾਬ ਵਿੱਚ ਵੱਖਰੇ ਵੱਖਰੇ ਸੰਗੀਤਕਾਰ ਹਨ ਅਤੇ ਹਰ ਇੱਕ ਇਨਸਾਨ ਦਾ ਆਪਣਾ ਪਸੰਦੀਦਾ ਸੰਗੀਤਕਾਰ ਹੈ ਜਿਵੇਂ ਕਿ ਮੈਨੂੰ ਬਹ ਚਾਰ ਜਿਹੜੇ ਸੰਗੀਤਕਾਰ ਹਨ ਜੋ ਬਹੁਤ ਜ਼ਿਆਦਾ ਪਸੰਦ ਹਨ ਜਿਵੇਂ ਕਿ ਰਣਜੀਤ ਬਾਵਾ ਸਿੱਧੂ ਮੂਸੇਆਲ਼ਾ ਐਮੀ ਵਿਰਕ ਅਤੇ ਗੁਰਦਾਸ ਮਾਨ ਕਿਉਂਕਿ ਇਨ੍ਹਾਂ ਦੇ ਜਿਹੜੇ ਗੀਤ ਹੁੰਦੇ ਹਨ ਉਹ ਬਹੁਤ ਹੀ ਵਧੀਆ ਹੁੰਦੇ ਹਨ ਅਤੇ ਇਨ੍ਹਾਂ ਦੀ ਆਵਾਜ਼ ਜਿਹੜੀ ਹੈ ਬਹੁਤ ਜ਼ਿਆਦਾ ਮਿੱਠੜੀ ਆਵਾਜ਼ ਹੈ ਅਤੇ ਜਿਵੇਂ ਕਿ ਰਣਜੀਤ ਬਾਵਾ ਦਾ ਰੋਟੀ ਗੀਤ ਸੀਗਾ ਜੋ ਕਿ ਬਾਹਰਲੇ ਦੇਸ਼ਾਂ ਦੇ ਉੱਤੇ ਲਿਖਿਆ ਗਿਆ ਸੀਗਾ ਕਿ ਕਿੱਦਾਂ ਬੱਚੇ ਉੱਥੇ ਮਿਹਨਤ ਕਰਦੇ ਹਨ ਅਤੇ ਉਹ ਗੀਤ ਜਿਹੜਾ ਸੀਗਾ ਬਹੁਤ ਜ਼ਿਆਦਾ ਪ੍ਰਸਿੱਧ ਹੋਇਆ ਸੀਗਾ ਅਤੇ ਦੂਜਾ ਸਿੱਧੂ ਮੂਸੇਆਲ਼ੇ ਦਾ ਉਣਾਹਠ ਗਿਆਰ੍ਹਾਂ ਜਿਹੜਾ ਗੀਤ ਸੀਗਾ ਉਹਦੇ ਟਰੈਕਟਰ ਉੱਤੇ ਸੀਗਾ ਅਤੇ ਉਹ ਬਹੁਤ ਜ਼ਿਆਦਾ ਫੇਮੱਸ ਹੋਇਆ ਸੀਗਾ ਅਤੇ ਅੱਜ ਦੀ ਯੂਥ ਜਿਹੜੀ ਜਨਰੇਸ਼ਨ ਸੀਗੀ ਯੰਗ ਜਨਰੇਸ਼ਨ ਉਹ ਉਹਨੂੰ ਬਹੁਤ ਜ਼ਿਆਦਾ ਪਸੰਦ ਕਰਦੀ ਸੀ ਅਤੇ ਉਸਦੇ ਗੀਤਾਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਕਰਦੀ ਸੀ ਅਤੇ ਐਮੀ ਵਿਰਕ ਜੋ ਕਿ ਬਹੁਤ ਹੀ ਵਧੀਆ ਇੱਕ ਸਿੰਗਰ ਵੀ ਹੈ ਅਤੇ ਨਾਲ਼ ਹੀ ਉਹ ਐਕਟਿੰਗ ਵੀ ਕਰਦਾ ਅਤੇ ਉਹ ਦੀਆਂ ਬਹੁਤ ਸਾਰੀਆਂ ਫਿਲਮਾਂ ਵੀ ਆਈਆਂ ਹਨ ਅਤੇ ਜਿਹੜੇ ਉਹਦੇ ਗੀਤ ਹਨ ਉਹ ਬਹੁਤ ਜ਼ਿਆਦਾ ਪ੍ਰਸਿੱਧ ਹਨ ਅਤੇ ਸਾਰੇ ਓਹਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹਨ